ਸਾਡੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਾਫ਼ ਸਾਫ਼ ਰੱਖਣ ਦੇ ਇਲਾਕਿਆਂ ਨੂੰ ਸਾਫ਼ ਰੱਖਣ ਲਈ ਸਾਡੇ ਸਾਰੇ ਬੜੇ ਵਧੀਆ ਉਪਾਏ ਕਰਦੇ ਨੇ ਅਸੀਂ ਸਾਰੇ ਜਣੇ ਆਪਣੇ ਗੇਟ ਦੇ ਅੱਗੇ ਅੱਗੇ ਜਾਂ ਆਸੇ ਪਾਸੇ ਸਾਰੇ ਵਧੀਆ ਝਾੜੂ ਵਗੈਰਾ ਮਾਰ ਕੇ ਸਫ਼ਾਈ ਕਰਦੇ ਹਾਂ ਇਸ ਲਈ ਅਸੀਂ ਬਾਹਰ ਸਾਰਿਆਂ ਨੇ ਕੂੜੇਦਾਨ ਲਗਾਏ ਹੋਏ ਨੇ ਗਿੱਲਾ ਕੂੜਾ ਅਲੱਗ ਅਤੇ ਸੁੱਕਾ ਕੂੜਾ ਅਲੱਗ ਰੱਖਦੇ ਹਾਂ ਅਤੇ ਗਲੀ ਵਿੱਚ ਇੱਕ ਮੁੰਡਾ ਵੀ ਰੱਖਿਆ ਹੋਇਆ ਹੈ ਉਹ ਜਿਹੜਾ ਸ ਦੋਨੋਂ ਕੂੜੇ ਅਲੱਗ ਅਲੱਗ ਲੈ ਜਾਂਦਾ ਹੈ ਅਤੇ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਦੱਸਿਆ ਹੋਇਆ ਕਿ ਸਾਰਾ ਕੂੜਾ ਕਿੱਦਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੂੜੇਦਾਨ ਵਿੱਚ ਪਾਉਣਾ ਹੈ ਅਤੇ ਸਾਡੇ ਆਂਢੀ ਗੁਆਂਢੀ ਵੀ ਬੜੇ ਚੰਗੇ ਨੇ ਉਹ ਵੀ ਇਸ ਗੱਲ ਦਾ ਬੜਾ ਧਿਆਨ ਰੱਖਦੇ ਨੇ ਕਿ ਸਾ ਆਸੇ ਪਾਸੇ ਕਿੱਦਾਂ ਸਾਫ਼ ਸਫ਼ਾਈ ਰੱਖਣੀ ਹੈ ਸਾਡੇ ਘਰ ਦੇ ਸਾਹਮਣੇ ਇੱਕ ਪਾਰਕ ਹੈ ਜਿਹੜੇ ਸਾਰੇ ਜਣੇ ਰਲ਼ ਕੇ ਪਾਰਕ ਦੀ ਵੀ ਵਧੀਆ ਦੇਖ ਭਾਲ ਕਰਦੇ ਨੇ ਓੱਥੇ ਬੂਟੇ ਬਾਟੇ ਵੀ ਲਗਾਏ ਹੋਏ ਨੇ ਸਾਰੇ ਮਾਲੀ ਰੱਖਿਆ ਹੋਇਆ ਸਾਰੇ ਉਹਨੂੰ ਸਾਰੇ ਪ੍ਰੇਰਿਤ ਕਰਦੇ ਰਹਿੰਦੇ ਨੇ ਕਿ ਤੂੰ ਵਧੀਆ ਵਧੀਆ ਸਫ਼ਾਈ ਕਰ ਅਤੇ ਉਹ ਵੀ ਬਹੁਤ ਵਧੀਆ ਸਫਾਈ ਰੱਖਦਾ ਹੈ ਸਾਡੇ ਘਰ ਦੇ ਆਸੇ ਪਾਸੇ ਦਰੱਖਤ ਦਰੁੱਖਤ ਨੇ ਉਹਨਾਂ ਦੇ ਉਹ ਵੀ ਸਾਰੇ ਬਹੁਤ ਸਾਫ਼ ਸੁਥਰੇ ਰੱਖਦੇ ਨੇ ਕੋਈ ਜ਼ਿਆਦਾ ਗੰਦ ਖ਼ਲਾਰਦਾ ਹੀ ਨਹੀਂ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਸਮਝ ਲੱਗ ਗਈ ਹੈ ਕਿ ਅਸੀਂ ਸਾਰਾ ਕੂੜਾ ਕੂੜੇਦਾਨ ਵਿੱਚ ਹੀ ਪਾਉਣਾ ਹੈ ਇਸ ਤਰ੍ਹਾਂ ਸਾਰੇ ਜਣੇ ਦੇ ਰਲ਼ ਰਲਣ ਮਿਲਣ ਨਾਲ਼ ਕਰਨ ਨਾਲ਼ ਸਾਡਾ ਇਲਾਕਾ ਬਹੁਤ ਜ਼ਿਆਦਾ ਸਾਫ਼ ਸੁਥਰਾ ਹੋ ਗਿਆ ਹੈ ਜਿਹੜਾ ਵੀ ਬਾਹਰੋਂ ਆਉਂਦਾ ਹੈ ਉਹ ਸਾਰੇ ਕਹਿੰਦੇ ਹੈ ਇਹ ਬਹੁਤ ਵਧੀਆ ਇਲਾਕਾ ਹੈ ਇਸ ਤਰ੍ਹਾਂ ਸਾਰੇ ਬਹੁਤ ਸਫ਼ਾਈ ਵੱਲ ਧਿਆਨ ਰੱਖਦੇ ਨੇ ਧੰਨਵਾਦ